ਸਾਡੇ ਪੰਜਾਬ ਵਿੱਚ ਬਹੁਤ ਸਾਰੇ ਧਰਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਜਿਵੇਂ ਕਿ ਸਾਡੇ ਪਿੰਡ ਵਿੱਚ ਤਿੰਨ ਗੁਰਦੁਆਰਾ ਸਾਹਿਬ ਹਨ ਔਰ ਜ਼ਿਆਦਾਤਰ ਸਿੱਖ ਧਰਮ ਹੈ ਔਰ ਸਿੱਖ ਧਰਮ ਉੱਥੇ ਜਾ ਕੇ ਕੀਰਤਨ ਸੁਣਦੇ ਨੇ ਮੱਥਾ ਟੇਕਦੇ ਨੇ ਔਰ ਜਿਵੇਂ ਕਿ ਸਾਡੇ ਪਿੰਡ ਵਿੱਚ ਇੱਕ ਮਸੀਤ ਹੈ ਜਿਹੜੇ ਮੁਸਲਿਮ ਧਰਮ ਨਾਲ ਸਬੰਧ ਰੱਖਦੇ ਹਨ ਉਹ ਉੱਥੇ ਜਾਂਦੇ ਹਨ ਔਰ ਸਾਡੇ ਪਿੰਡ ਵਿੱਚ ਇੱਕ ਮੰਦਰ ਹੈ ਔਰ ਜਿਹੜੇ ਹਿੰਦੂ ਹਨ ਉੱਥੇ ਜਾ ਕੇ ਮੱਥਾ ਟੇਕਦੇ ਹਨ ਔਰ ਮੂਰਤੀ ਪੂਜਾ ਕਰਦੇ ਹਨ ਔਰ ਸਾਡੇ ਜ਼ਿਆਦਾਤਰ ਅਸੀਂ ਸਾਡੇ ਮਸੀਹ ਭਾਈਚਾਰਾ ਹੈ ਔਰ ਅਸੀਂ ਮਸੀਹ ਭਾਈਚਾਰੇ ਵਿੱਚ ਰਹਿੰਦੇ ਹਾਂ ਔਰ ਅਸੀਂ ਚਰਚ ਜਾਂਦੇ ਹਾਂ ਵਚਨ ਪੜ੍ਹਦੇ ਹਾਂ ਔਰ ਬਾਇਬਲ ਪੜ੍ਹਦੇ ਹਾਂ ਪ੍ਰਵਚਨ ਸੁਣਦੇ ਹਾਂ ਔਰ ਅਸੀਂ ਜ਼ਿਆਦਾਤਰ ਉੱਥੇ ਦੁੱਖਾਂ ਦਾ ਨਿਵਾਰਨ ਹੁੰਦਾ ਹੈ ਔਰ ਜ਼ਿਆਦਾਤਰ ਉੱਥੇ ਅਸੀਂ ਗੀਤ ਭਜਨ ਵੀ ਬੋਲਦੇ ਹਾਂ ਬਾਇਬਲ ਵੀ ਪੜ੍ਹਦੇ ਹਾਂ ਵਚਨ ਵੀ ਸੁਣਦੇ ਹਾਂ ਔਰ ਉੱਥੇ ਜਾ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਸੀਂ ਉੱਥੇ ਗੀਤਾਂ ਭਜਨਾਂ ਰਾਹੀਂ ਔਰ ਛੁਟਕਾਰਾ ਪਾਉਂਦੇ ਹਾਂ